ਹੈਲੋ ਠੀਕ ਹਾਂ ਤੂੰ ਸੁਣਾ ਯਾਰ ਮੈਨੂੰ ਨਾ ਟੈਂਸ਼ਨ ਨਹੀਂ ਪਈ ਖੜ੍ਹੀ ਆ ਹੁਣ ਆਪਣੀ ਦੇਖ ਪਲੱਸ ਟੂ ਵੀ ਕਲੀਅਰ ਹੋ ਗਈ ਹੈ ਅਤੇ ਹੁਣ ਨਾਨ ਮੈਡੀਕਲ ਹੈ ਆਪਣੇ ਕੋਲ ਅਤੇ ਹੁਣ ਕਿਹੜੇ ਕਾਲਜ 'ਚ ਐਡਮਿਸ਼ਨ ਲਵਾਂ ਇੰਨੇ ਸਾਰੇ ਐਡਵਾਈਜ ਕਰੀ ਜਾਂਦੇ ਆ ਕੋਈ ਵਧੀਆ ਵੀ ਨਹੀਂ ਲੱਗ ਰਿਹਾ ਕੁਛ ਨਹੀਂ ਪਤਾ ਹੈਗਾ ਅੱਛਾ ਖਾਲਸਾ ਕਾਲਜ ਕਿੱਥੇ ਆ ਅੱਛਾ ਅੰਮ੍ਰਿਤਸਰ ਠੀਕ ਆ ਠੀਕ ਆ ਐਂ ਤਾਂ ਬਹੁਤ ਸਾਰੇ ਐਡਵਾਈਸਸ ਕਰ ਰਹੇ ਆ ਇਹ ਐਵੇਂ ਆ ਨਾ ਵੀ ਇੱਕ ਵਾਰੀ ਵਿਜ਼ਿਟ ਕਰ ਆਈਏ ਦੇਖ ਆਈਏ ਵੀ ਕੀ ਕੁਛ ਹੈ ਕਿਸ ਤਰ੍ਹਾਂ ਹੈ ਹੈ ਨਾ ਵਿਜ਼ਿਟ ਕਰਨ ਆਏਂ ਤਾਂ ਮੇਰੀ ਐ ਮੇਰੀ ਗੱਲ ਸੁਣ ਆਏਂ ਤਾਂ ਮੇਰੀ ਸਕਾਲਰਸ਼ਿਪ ਵੀ ਆ ਜਾਊਗੀ ਕੀ ਕਹਿੰਦੇ ਆ ਮੈਂ ਐਸ ਸੀ ਸਟੂਡੈਂਟ ਹਾਂ ਨਾ ਹਾਂ ਅਤੇ ਤਾਂ ਕਰਕੇ ਜੇ ਤੂੰ ਕਹਿੰਦੀ ਆ ਜੇ ਤੂੰ ਕਹਿੰਦੀ ਆ ਤਾਂ ਆਪਾਂ ਜਾ ਕੇ ਇੱਕ ਵਾਰੀ ਅੰਮ੍ਰਿਤਸਰ ਦੇਖ ਆਉਂਦੇ ਹਾਂ ਉਹ ਵਾਲੀ ਯੂਨੀਵਰਸਿਟੀ 'ਚ ਠੀਕ ਹੈ ਅੱਛਾ ਠੀਕ ਆ ਅਤੇ ਉੱਥੇ ਰਹਿਣ ਸਹਿਣ ਕਿਵੇਂ ਹੈ ਵੈਨਸ ਅਵੇਲੇਬਲ ਹੈਗੀਆਂ ਨੇ ਨਹੀਂ ਫਿਰ ਨਾ ਮੇਰੀ ਗੱਲ ਸੁਣੋ ਪੀ ਜੀ ਦੇ ਵਿੱਚ ਤਾਂ ਅਲਾਓ ਨਹੀਂ ਕਰਨਗੇ ਘਰੇ ਮਤਲਬ ਹੋਸਟਲ ਦੇ ਵਿੱਚ ਠੀਕ ਰਹੂਗਾ ਫਿਰ ਵੀ ਅਤੇ ਜਿਵੇਂ ਘਰ ਆਏਂ ਕਹਿ ਦਿੰਦੇ ਆ ਵੀ ਪੀ ਜੀ ਵਾਲੀਆਂ ਕੁੜੀਆਂ ਬਾਹਰ ਫਿਰਦੀਆਂ ਰਹਿੰਦੀਆਂ ਨੇ ਹੈ ਨਾ ਅਤੇ ਆਪਣਿਆਂ ਵਾਲੀ ਸਾਈਡ ਤਾਂ ਤੈਨੂੰ ਪਤਾ ਹੀ ਹੈ ਪਿੰਡਾਂ ਵਾਲਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਕਹਿ ਦਿੰਦੇ ਹੁੰਦੇ ਆ ਵੀ ਬਾਹਰ ਜਾ ਕੇ ਕੁੜੀ ਵਿਗੜ ਗਈ ਹੈ ਹੈ ਨਾ

ਹਾਂ

ਹਾਂ ਹਾਂ ਆਏਂ ਤਾਂ ਜਿਵੇਂ ਆਪਣੇ ਜਿਹੜੇ ਸਬਜੈਕਟ ਸੀਗੇ ਮੈਥ ਆਹਾ ਬਾਇਲੋਜੀ ਕਮਿਸਟਰੀ ਫਿਜਿਕਸ ਹੈ ਨਾ ਜਿਹੜੇ ਵੀ ਸਬਜੈਕਟ ਸੀ ਉਹਦੇ ਅਕੋਰਡਿੰਗ ਤਾਂ ਵੀ ਜਿਵੇਂ ਬੀ ਐਸ ਈ ਬਣਦੀ ਆ ਆਪਾਂ ਬੀ ਏ ਬੂਏ ਤਾਂ ਕਰ ਵੀ ਨਹੀਂ ਸਕਦੇ ਹੈਗੇ ਹੈ ਨਾ ਨਹੀਂ ਫਿਰ ਉਹ ਕੀ ਉਹ ਪਤਾ ਕੀ ਗੱਲ ਆ ਮਾਰਕਸ ਅੱਗੇ ਜਾ ਕੇ ਘੱਟ ਜਾਣਗੇ ਜਾਂ ਆਪਾਂ ਨੋਨ ਮੈਡੀਕਲ ਹੁਣ ਲਈ ਹੋਈ ਹੈ ਹੈ ਨਾ ਆਪਾਂ ਪਲਸ ਵਨ ਪਲਸ ਟੂ ਦੇ ਵਿੱਚ ਆਪਾਂ ਪੜ੍ਹੇ ਹੀ ਨਹੀਂ ਆਰਟਸ ਨਹੀਂ ਪੜ੍ਹੀ ਹੈਗੀ ਆਪਾਂ ਜਿਵੇਂ ਆਰਟਸ ਵਾਲੇ ਸਬਜੈਕਟ ਹਿਸਟਰੀ ਹਿਸਟਰੀ ਵਗੈਰਾ ਹੁੰਦੀ ਆ ਹੈ ਨਾ ਤਾਂ ਉਹ ਤਾਂ ਪੜ੍ਹਿਆ ਹੀ ਨਹੀਂ ਆਪਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਦੇ ਵਿੱਚ ਕਰ ਸਕਦੇ ਹਾਂ ਅੱਛਾ ਚਲੋ ਆਪਾਂ ਐਂ ਕਰਦੇ ਹਾਂ ਆਪਾਂ ਐਂ ਕਰਦੇ ਹਾਂ ਇਸ ਮੰਡੇ ਨਾ ਆਪਾਂ ਚੱਲ ਕੇ ਆਉਂਦੇ ਹਾਂ ਪਹਿਲਾਂ ਤਾਂ ਆਪਾਂ ਅੰਮ੍ਰਿਤਸਰ ਜਾਵਾਂਗੇ ਜੇ ਅੰਮ੍ਰਿਤਸਰ ਨਾ ਵਧੀਆ ਲੱਗੀ ਵੈਸੇ ਤਾਂ ਮੈਨੂੰ ਪਤਾ ਉਹ ਵਧੀਆ ਹੋਊਗੀ ਜੇ ਤੂੰ ਕਹਿ ਰਹੀ ਹੈ ਤਾਂ ਠੀਕ ਹੈ ਹਾਂ ਜੇ ਵੈਸੇ ਹਾਂ ਉੱਥੇ ਮੇਰੀ ਇੱਕ ਫਰੈਂਡ ਹੈ ਨਾ ਉਹ ਵੀ ਦੱਸਦੀ ਸੀ ਵੀ ਉੱਥੇ ਲੱਗ ਜਾ ਤੂੰ ਉੱਥੇ ਗੁਰੂ ਨਾਨਕ ਯੂਨੀਵਰਸਿਟੀ 'ਚ ਹਾਂ ਹੋਰ ਚਲ ਠੀਕ ਹੈ ਓਕੇ ਹਾਂ ਹਾਂ ਮੇਰੀ ਗੱਲ ਸੁਣ ਮੰਡੇ ਹੀ ਚੱਲਾਂਗੇ ਅਤੇ ਪਾ ਕੇ ਕੀ ਜਾਵਾਂਗੇ ਪਾ ਕੇ ਕੀ ਜਾਵਾਂਗੇ ਕਮੀਜ਼ ਕਮੀਜ਼ ਕੁੜਤਾ ਪਾ ਕੇ ਜਾਵਾਂਗੇ ਜਾਂ ਜੀਨ 'ਤੇ ਕੁੜਤਾ ਟੋਪ ਟੂਪ ਵਗੈਰਾ ਠੀਕ ਹੈ ਓਕੇ ਓਕੇ ਬਾਏ ਆ ਜਈ ਤੂੰ ਮੇਰੇ ਘਰ ਆ ਜਈ ਠੀਕ ਹੈ ਬਾਏ